ਭਾਰਤ ਸਰਕਾਰ ਦੀ ਆਯੂਸ਼ਮਾਨ ਯੋਜਨਾ ਨੂੰ ਬਹੁਤ ਉਪਰਾਲਾ ਦਿੱਤਾ ਜਾ ਰਿਹਾ ਹੈ ਪਹਿਲਾਂ ਇਹ ਸੱਤਰ ਸਾਲ ਤੋਂ ਛੋਟਿਆਂ ਤੱਕ ਹੀ ਗਿਣੀ ਗਈ ਸੀ ਹੁਣ ਹਰ ਆਦਮੀ ਔਰਤ ਜੋ ਸੱਤਰ ਸਾਲ ਤੋਂ ਉੱਪਰ ਦੀ ਉਮਰ ਦਾ ਹੈ ਚਾਹੇ ਉਹ ਅਮੀਰ ਹੋਵੇ ਜਾਂ ਗਰੀਬ ਹੋਵੇ ਉਹ ਆਪਣੀ ਬਿਮਾਰੀ ਵਾਸਤੇ ਆਯੂਸ਼ਮਾਨ ਕਾਰਡ ਬਣਾ ਸਕਦਾ ਹੈ ਅਜੇ ਪੰਜ ਲੱਖ ਤੱਕ ਦਾ ਉਹਦਾ ਇਲਾਜ ਬਿਨਾਂ ਪੈਸੇ ਤੋਂ ਸਰਕਾਰੀ ਹੋਸਪੀਟਲ ਜਾਂ ਮਨਜ਼ੂਰ ਸ਼ੁਦਾ ਹੋਸਪਿਟਲ 'ਚ ਕੀਤਾ ਜਾਂਦਾ ਇਹਦੇ ਨਾਲ ਗਰੀਬ ਆਦਮੀ ਜੋ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਦਾ ਇਲਾਜ ਦਾ ਹੋਵੇਗਾ ਅਸੀਂ ਅ ਅਜੇ ਤੱਕ ਕੋਈ ਫ਼ਾਇਦਾ ਨਹੀਂ ਉਠਾਇਆ ਨਾ ਹੀ ਕੋਈ ਲੋੜ ਪਈ ਹੈ ਗਰੀਬ ਆਦਮੀਆਂ ਨੂੰ ਹਸਪਤਾਲਾਂ ਦੇ ਵਿੱਚ ਇਸ ਕਾਰਡ ਦੇ ਉੱਤੇ ਬੜੀ ਹੀ ਇਹ ਰਿਆਤ ਦਿੱਤੀ ਗਈ ਹੈ ਇਸ ਤਰ੍ਹਾਂ ਦੀਆਂ ਹੋਰ ਸਕੀਮਾਂ ਵੀ ਸਰਕਾਰ ਨੂੰ ਗਰੀਬਾਂ ਵਾਸਤੇ ਕਰਨੀਆਂ ਚਾਹੀਦੀਆਂ ਹਨ ਜਿਵੇਂ ਕਿ ਰੇਲਵੇ ਦੀ